ਇੱਥੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਆਪਣੇ ਗੱਡੀਆਂ ਮੋਟਰਾਂ ਆਉਣ ਜਾਣ ਦੇ ਸਾਧਨ ਕਾਫ਼ੀ ਨੇ ਜਿੱਦਾਂ ਆਟੋ ਵੀ ਚੱਲਦੇ ਹੈ ਮਤਲਬ ਬੱਸਾਂ ਵੀ ਚੱਲਦੀਆਂ ਰਿਕਸ਼ੇ ਵੀ ਹੈ ਬੈਟਰੀਆਂ ਵੀ ਹੈ ਹੋਰ ਆਪਣੀ ਕਾਰਾਂ ਵੀ ਹੈ ਹਰ ਤਰ੍ਹਾਂ ਦਾ ਸਿਸਟਮ ਚੱਲਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਣ ਵਾਸਤੇ ਅਤੇ ਇਸ ਕਰਕੇ ਕਾਫ਼ੀ ਮਤਲਬ ਆਉਣ ਜਾਣ ਦਾ ਸਾਧਨ ਅੱਛੇ ਹੈ ਰੋਜ਼ਾਨਾ ਜੀਵਨ ਦੇ ਵਿੱਚ ਬਹੁਤ ਠੀਕ ਰਹਿੰਦਾ ਆਉਣ ਜਾਣ ਦੇ ਸਾਧਨ ਜਿੱਦਾਂ ਕੁਝ ਬੱਸਾਂ ਪ੍ਰਾਈਵੇਟ ਵੀ ਨੇ ਸਰਕਾਰ ਨੇ ਆਪਣੇ ਢੰਗ ਤਰੀਕੇ ਨਾਲ਼ ਪਬਲਿਕ ਨੂੰ ਸਹੂਲਤਾਂ ਦਿੱਤੀਆਂ ਇਸ ਕਰਕੇ ਜਨਤਾ ਨੂੰ ਕਿਸੇ ਕਿਸਮ ਦੀ ਵੀ ਪ੍ਰੋਬਲਮ ਨਹੀਂ ਆਉਂਦੀ ਹੈ ਧੰਨਵਾਦ